ਹਾਂਜੀ ਮੇਰਾ ਬੁਟੀਕ ਦਾ ਕੰਮ ਆ ਮੇਰਾ ਨਾਂ ਕਿਰਨ ਆ ਮੈਂ ਕਿਰਨ ਦੇ ਨਾਂ 'ਤੇ ਬੁਟੀਕ ਚਲਾ ਰਹੀ ਹਾਂ ਅਤੇ ਉਹ ਮੇਰਾ ਇੱਕ ਕਾਰੋਬਾਰ ਹੈਗਾ ਇੱਕ ਵਧੀਆ ਮਤਲਬ ਕਹਿ ਲਓ ਕੰਮ ਹੈਗਾ ਅਤੇ ਮੈਂ ਉਹਦੇ ਵਿੱਚ ਉਹ ਪੰਜ ਛੇ ਲੜਕੀਆਂ ਵੀ ਰੱਖੀਆਂ ਹੋਈਆਂ ਨੇ ਆਪਣੇ ਬੁਟੀਕ 'ਤੇ ਕੰਮ ਕਰਨ ਵਾਸਤੇ ਅਤੇ ਮੇਰੇ ਗਾਹਕ ਵੀ ਬਹੁਤ ਨੇ ਮਤਲਬ ਪਹਿਲਾਂ ਮੈਂ ਇੱਥੇ ਇੱਥੇ ਨੇੜੇ ਤੇੜੇ ਹੀ ਕਰਦੇ ਸੀ ਬਟ ਹੁਣ ਮੈਨੂੰ ਬਾਹਰੋਂ ਵੀ ਆਰਡਰ ਆਉਂਦੇ ਨੇ ਕਿਉਂਕਿ ਮੇਰੇ ਗਾਹਕ ਮੇਰੇ ਤੋਂ ਖੁਸ਼ ਹੀ ਇੰਨੇ ਨੇ ਵੀ ਮੇਰੇ ਕੰਮ ਨੂੰ ਬਹੁਤ ਪਸੰਦ ਕਰਦੇ ਨੇ ਅਤੇ ਮੈਨੂੰ ਆਨਲਾਈਨ ਆਰਡਰ ਆਉਂਦੇ ਆ ਮੈਂ ਬੁਟੀਕ ਚਲਾਨੀ ਹਾਂ ਅਤੇ ਲੜਕੀਆਂ ਨੂੰ ਵੀ ਸਿਕਸ਼ਾ ਦਿੰਦੀ ਹਾਂ ਵੀ ਵਧੀਆ ਕੰਮ ਸਿੱਖ ਜਾਣ ਅਤੇ ਉਹ ਅੱਗੇ ਜਾ ਕੇ ਆਪਣਾ ਬੁਟੀਕ ਖੋਲ੍ਹ ਸਕਣ ਮੈਂ ਇੱਕ ਫ ਫੈਸ਼ਨ ਡਿਜ਼ਾਈਨਰ ਹਾਂ ਜਿਸ ਕਾਰਨ ਮੇਰੇ ਕ ਕੱਪੜੇ ਦੀ ਮੰਨ ਲਓ ਇੱਕ ਟੁਕੜਾ ਇੱਕ ਕਮੀਜ਼ ਦੀ ਪਲਾਜੋ ਸਲਵਾਰ ਸੂਟ ਹੋਇਆ ਮੰਨ ਲਓ ਸਾਰਿਆਂ ਦੀ ਅਲੱਗ ਅਲੱਗ ਕੀਮਤ ਆ ਮੈਂ ਬਾਹਲੀ ਹੀ ਨਹੀਂ ਰੱਖੀ ਹੋਈ ਕਿਉਂਕਿ ਮੈਂ ਪੈਸੇ ਤੋਂ ਪਹਿਲਾਂ ਆਪਣੇ ਗਾਹਕ ਨੂੰ ਤਰਜੀਹ ਦੇਵਾਂਗੀ ਮੈਂ ਦੇਖਦੀ ਹਾਂ ਵੀ ਬ ਮੇਰੇ ਗਾਹਕ ਮੇਰੇ ਨਾਲ ਜੁੜਨ ਨਾ ਕਿ ਮੈਂ ਪੈਸਾ ਮੇਰੇ ਲਈ ਇੰਨਾਂ ਮਾਇਨੇ ਨਹੀਂ ਰੱਖਦਾ ਜਿੰਨਾਂ ਮੈਨੂੰ ਮੇਰਾ ਭਾਈਚਾਰਾ ਮਾਇਨੇ ਰੱਖਦਾ ਕਿਉਂਕਿ ਮੇਰੇ ਗਾਹਕ ਨੇ ਜੋ ਉਹ ਮੈਨੂੰ ਬੜਾ ਸਾਥ ਦਿੰਦੇ ਨੇ ਮੈਨੂੰ ਬੜਾ ਮੋਟੀਵੇਸ਼ਨ ਕਰਦੇ ਨੇ ਵੀ ਮੈਮ ਤੁਸੀਂ ਹੋਰ ਕੰਮ ਚਲਾਓ ਨਾਲ ਤੁਸੀਂ ਹੋਰ ਅੱਗੇ ਵਧੋ ਤਾਂ ਕਿ ਤੁਹਾਡਾ ਹੋਰ ਇਹ ਕਿ ਸਰਕਲ ਵੱਧ ਸਕੇ ਅਤੇ ਮੈਂ ਇੱਕ ਮੰਨ ਲਓ ਮੇਰਾ ਇੱਕ ਬਰਾਊਜ ਹੈ ਨਾ ਜੋ ਉਹ ਨ ਦੋ ਤਿੰਨ ਸੌ ਤੋਂ ਮੰਨ ਲਓ ਪੰਜ ਸੌ ਤੱਕ ਦੀ ਰੇਂਜ ਦਾ ਹੁੰਦਾ ਇਸ ਤੋਂ ਵੱਧ ਨਹੀਂ ਮੇਰਾ ਸਲਵਾਰ ਸੂਟ ਵੀ ਸਟਿਚ ਕਰੀਦਾ ਤਾਂ ਉਹ ਵੀ ਇਹ ਦੋ ਤਿੰਨ ਸੌ ਤੱਕ ਹੀ ਰੱਖਿਆ ਮੈਂ ਜ਼ਿਆਦਾ ਰੇਂਜ ਨਹੀਂ ਰੱਖਦੀ ਕਿਉਂਕਿ ਮੈਨੂੰ ਪਤਾ ਵੀ ਮੇਰੇ ਗਾਹਕ ਇੰਨਾਂ ਐਫਟ ਨਹੀਂ ਕਰ ਸਕਦੇ ਜੋ ਵਧੀਆ ਰਿਚ ਹੁੰਦੇ ਨੇ ਉਹ ਤਾਂ ਕਰਦੇ ਨੇ ਬਟ ਜੋ ਗਰੀਬ ਹੁੰਦੇ ਨੇ ਉਹਨਾਂ ਤੋਂ ਇੰਨਾਂ ਮੈਂ ਆਪਣੇ ਏ ਕੀਮਤ ਬਹੁਤ ਘੱਟ ਰੱਖੀ ਹੋਈ ਹੈ ਤਾਂ ਕਿ ਮੈਂ ਆਪਣੇ ਗਾਹਕ ਨਾ ਨਿਰਾਸ਼ ਕਰ ਸਕਾਂ ਬਾਕੀ ਜੋ ਉਹਨਾਂ ਦੀ ਜਿੰਨੀ ਇੱਛਾ ਹੁੰਦੀ ਉਹ ਦੇ ਜਾਂਦੇ ਨੇ ਮੈਂ ਇਹਨਾਂ ਤੋਂ ਜ਼ਿਆਦਾ ਨਹੀਂ ਕਹਿੰਦੀ ਵੀ ਤੁਸੀਂ ਮੈਨੂੰ ਇੰਨੇ ਨਹੀਂ ਦਿੱਤੇ ਯੇਹ ਵੋ ਇਸ ਲਈ ਮੇਰੇ ਗਾਹਕ ਮੇਰੇ ਤੋਂ ਕ ਖੁਸ਼ ਵੀ ਨੇ ਅਤੇ ਮੇਰੇ ਤੋਂ ਕਾਫੀ ਉਮੀਦ ਵੀ ਰੱਖਦੇ ਨੇ ਮੈਮ ਤੁਸੀਂ ਹੋਰ ਕੰਮ ਕਰੋਗੇ ਤਾਂ ਸਾਨੂੰ ਵਧੀਆ ਰਹੇਗਾ